ਇਹਨਾਂ ਦੀਆਂ ਚਾਲਾਂ ਬਾਰੇ ਮੈਨੂੰ ਕੁਛ ਖ਼ਾਸ ਤਾਂ ਨਹੀਂ ਪਤਾ ਪਰ ਮੇਰੀ ਮੇਰੇ ਘਰ ਦੇ ਮੇਰੇ ਘਰ ਦੇ ਨੇੜੇ ਹੀ ਇੱਕ ਇੱਕ ਔਰਤ ਇੱਕ ਔਰਤ ਉਹਦਾ ਦਾ ਕਿਸੇ ਨੇ ਕਤਲ ਕਰ ਦਿੱਤਾ ਸੀਗਾ ਅਤੇ ਸਾਨੂੰ ਸਾਰੇ ਸਾਰੇ ਮੁਹੱਲਾ ਨਿਵਾਸੀਆਂ ਨੂੰ ਇਹ ਹੀ ਲੱਗਦਾ ਹੁੰਦਾ ਸੀ ਕਿ ਉਹਦੇ ਉਹਦੇ ਉਹਦੇ ਹਸਬੈਂਡ ਨੇ ਹੀ ਉਸਦੀ ਉਹਦੇ ਹਸਬੈਂਡ ਨੇ ਉਸਦੀ ਮੌਤ ਕੀਤੀ ਹੈ ਪਰ ਇੱਦਾਂ ਦਾ ਕੁਛ ਵੀ ਨਹੀਂ ਸੀ ਪਰ ਇੱਦਾਂ ਦਾ ਕੁਛ ਵੀ ਨਹੀਂ ਸੀ ਐਂਡ 'ਤੇ ਜਦੋਂ ਪੁਲਿਸ ਨੇ ਤਹਿਕੀਕਾਤ ਕੀਤੀ ਤਾਂ ਉਹਨਾਂ ਦਾ ਗੁਆਂਢੀ ਸੀ ਜੋ ਉਹਨਾਂ ਤੋਂ ਜੋ ਉਹਨਾਂ ਤੋਂ ਜਲਸੀ ਜੈਲਸੀ ਕਰਦਾ ਸੀ ਉਸਨੇ ਹੀ ਉਸ ਉਸ ਔਰਤ ਦੀ ਉਸ ਔਰਤ ਨੂੰ ਮਾਰ ਦਿੱਤਾ ਸੀ